ਪੰਛੀ ਨਿਗਰਾਨ ਬਣਨ ਲਈ ਕੁਦਰਤ ਨਾਲ ਪਿਆਰ ਹੋਣਾ ਬਹੁਤ ਜਰੂਰੀ ਹੈ ਸ਼ੁਰੂਆਤ ਕਰਨ ਵਾਲੇ ਪੰਛੀ ਨਿਗਰਾਨ ਲਈ ਵਾਤਾਵਰਣ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਪੰਛੀਆਂ ਨੂੰ ਇਕੱਠ ਵਿੱਚ ਰਹਿਣਾ ਪਸੰਦ ਹੁੰਦਾ ਹੈ ਉਹ ਥੋੜੀ ਜਿਹੀ ਵੀ ਪਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਆਪਣੀਆਂ ਉਹਨਾਂ ਜਗਾਵਾਂ ਨੂੰ ਛੱਡ ਕੇ ਚਲੇ ਜਾਂਦੇ ਹਨ ਇਸ ਲਈ ਸਾਨੂੰ ਬਾਈ ਨੌਕਰ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਅਸੀਂ ਪੰਛੀਆਂ ਨੂੰ ਤੰਗ ਕੀਤੇ ਬਿਨਾਂ ਦੂਰੋਂ ਹੀ ਦੇਖ ਸਕੀਏ ਪੰਛੀਆਂ ਦੇ ਆਲਣੇ ਤੋਂ ਸਾਨੂੰ ਹਮੇਸ਼ਾ ਦੂਰ ਹੀ ਰਹਿਣਾ ਚਾਹੀਦਾ ਹੈ ਪੰਛੀਆਂ ਦੇ ਆਵਾਜ ਦੇ ਕੋਲ ਕਿਸੇ ਤਰੀਕੇ ਦਾ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਅਸਲ ਵਿੱਚ ਪੰਛੀਆਂ ਦੀ ਚਹ ਚਹਾਟ ਤੇ ਉਹਨਾਂ ਦੇ ਰਹਿਣ ਦੇ ਤਰੀਕੇ ਤੋਂ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਜਿਵੇਂ ਇਕੱਠ ਵਿੱਚ ਰਹਿਣਾ ਇਕੱਠ ਵਿੱਚ ਕੰਮ ਕਰਨਾ ਤੇ ਆਪਸ ਵਿੱਚ ਹਰ ਚੀਜ਼ ਦਾ ਵੰਡ ਵੰਡਾ ਕਰਨਾ ਆਪਣੇ ਤੋਂ ਜਿਆਦਾ ਨੌਲੇਜ ਰੱਖਣ ਵਾਲੇ ਪੰਛੀਵਾਚਕਾਂ ਨਾਲ ਮੇਲ ਜੋਲ ਹੋਣਾ ਚਾਹੀਦਾ ਹੈ ਪੰਛੀਆਂ ਨੂੰ ਦੇਖਣ ਲਈ ਸਵੇਰੇ ਉੱਠਣ ਦੀ ਆਦਤ ਪਾਣੀ ਚਾਹੀਦੀ ਹੈ